ਹੈਲੋ ਐਮਾਜੋਨ ਮੈਂ ਕਸਟਮਰ ਗੱਲ ਕਰ ਰਹੀ ਹਾਂ ਮੇਰਾ ਕਸਟਮਰ ਕੇਅਰ ਆਈ ਡੀ ਨੰਬਰ ਹੈ ਟੂ ਟੂ ਵੰਨ ਵੰਨ ਸਿਕਸ ਸੈਵਨ ਅਤੇ ਮੈਂ ਗਲਤੀ ਨਾਲ ਆਪਣੀ ਹੈਡਫੋਨ ਦੀ ਕੁਆਂਟਿਟੀ ਹੈ ਉਸਨੂੰ ਦੋ ਕਰ ਦਿੱਤਾ ਹੈ ਬਲਕਿ ਮੈਨੂੰ ਇੱਕ ਚਾਹੀਦਾ ਤਾਂ ਮੈਂ ਵੈਬਸਾਈਟ 'ਤੇ ਚੈੱਕ ਕਰ ਰਹੀ ਸੀ ਤਾਂ ਕਿਰਪਾ ਕਰਕੇ ਜੇ ਮੈਂ ਉਸਨੂੰ ਆਪਣੇ ਵੱਲੋਂ ਚੇਂਜ ਕਰ ਰਹੀ ਤਾਂ ਉਹ ਹੋ ਨਹੀਂ ਰਿਹਾ ਤਾਂ ਉਸਨੂੰ ਕੁਆਂਟਿਟੀ ਨੂੰ ਇੱਕ ਕੀਤਾ ਜਾ ਸਕੇ ਉਹ ਗਲਤੀ ਨਾਲ ਦੋ ਹੋ ਚੁੱਕਿਆ ਹੈ ਅਤੇ ਉਸਨੂੰ ਘਟਾ ਕੇ ਇੱਕ ਕੀਤਾ ਜਾ ਸਕੇ ਮੈਨੂੰ ਇੱਕ ਦੀ ਹੀ ਜ਼ਰੂਰਤ ਹੈ ਕਿਉਂਕਿ ਜੇ ਮੈਂ ਦੋ ਓਰਡਰ ਕਰਾਂਗੀ ਤਾਂ ਉਸਦਾ ਪ੍ਰਾਈਜ਼ ਵੀ ਵੱਧ ਜਾਏਗਾ ਪਰ ਮੈਨੂੰ ਹਾਲੇ ਇੱਕ ਹੈਡਫੋਨ ਦੀ ਜੋੜੀ ਦੀ ਜ਼ਰੂਰਤ ਹੈ ਮੈਨੂੰ ਦੋ ਹੈਡਫੋਨ ਨਹੀਂ ਚਾਹੀਦੇ ਤਾਂ ਕਿਰਪਾ ਕਰਕੇ ਤੁਸੀਂ ਆਪਣੇ ਤਰਫ ਤੋਂ ਉਸਨੂੰ ਕੈਂਸਲ ਕਰ ਦਿਓ ਕਿਉਂਕਿ ਮੈਂ ਉਸਨੂੰ ਵੈੱਬਸਾਈਟ 'ਤੇ ਮੈਂ ਉਸਨੂੰ ਐਕਸਪਲੋਰ ਕੀਤਾ ਮੈਂ ਵੈਬਸਾਈਟ 'ਤੇ ਉਹਨੂੰ ਦੇਖ ਰਹੀ ਸੀ ਤਾਂ ਉਹ ਗਲਤੀ ਨਾਲ ਦੋ ਜੋੜੀ ਹੋ ਚੁੱਕੀ ਹੈ ਅਤੇ ਉਹ ਵੱਧ ਜੋੜੀ ਨੂੰ ਮੈਂ ਹਟਾਉਣਾ ਚਾਹੁੰਦੀ ਹਾਂ ਅਤੇ ਕਿਰਪਾ ਕਰਕੇ ਉਸਨੂੰ ਹਟਾ ਦਿੱਤਾ ਜਾਵੇ ਸਫਲਤਾਪੂਰਵਕ ਕਿਉਂਕਿ ਮੈਨੂੰ ਇੱਕ ਹੀ ਜੋੜੀ ਦੀ ਜ਼ਰੂਰਤ ਹੈ ਅਤੇ ਕਿਉਂਕਿ ਐਂਡ ਉਸਦੀ ਇਸਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਕਿਉਂਕਿ ਉਸ 'ਤੇ ਸੇਲ ਸੀਗੀ ਅਤੇ ਉਹ ਸੇਲ ਕਿਤੇ ਨਿਕਲ ਨਾ ਜਾਵੇ ਇਸ ਕਰਕੇ ਉਸਨੂੰ ਜਲਦੀ ਤੋਂ ਜਲਦੀ ਹਟਾ ਦਿੱਤਾ ਜਾਵੇ ਧੰਨਵਾਦ ਹੋਵੇਗਾ ਤੁਹਾਡਾ ਬਹੁਤ ਬਹੁਤ